ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਹਾਂ ਹਾਂ ਮੈਡਮ ਹੋਰ ਠੀਕ ਠਾਕ ਹੋ ਹਾਂ ਵਧੀਆ ਵਧੀਆ ਹਾਂ ਠੀਕ ਹੈ ਠੀਕ ਹੈ ਜਿੱਦਾਂ ਮੈਂਹਾ ਵੀ ਅੱਜ ਕੱਲ੍ਹ ਦੇਖੋ ਮਤਲਬ ਬੱਚੇ ਪੜ੍ਹਦੇ ਆ ਅਤੇ ਫਿਰ ਫੌਰਨ ਕੰਟਰੀ ਦੇ ਸੱਜੇ ਖੱਬੇ ਜਾਣ ਦਾ ਦੋਸਤੀ ਦੇ ਵਿੱਚ ਇੱਕ ਦੋਸਤ ਜਾ ਰਿਹਾ ਦੂਜਾ ਹੋਰ ਬੜਾ ਟਰੈ ਹੋਰ ਮੈਡਮ ਕਮਾਲ ਹੋ ਗਈ ਮੈਂ ਤਾਂ ਬੜਾ ਹੈਰਾਨ ਆ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਫਿਰ ਦੇਖੋ ਹਾਂ ਠੀਕ ਹੈ ਠੀਕ ਨਹੀਂ ਐਸੀ ਕੋਈ ਗੱਲ ਨਹੀਂ ਆਪਣੇ ਸੀ ਐੱਮ ਜਿਹੜੇ ਭਗਵੰਤ ਮਾਨ ਹੁਣੀ ਕਾਫ਼ੀ ਜ਼ੋਰ ਲਾ ਰਹੇ ਆ ਉਹ ਕਹਿੰਦੇ ਆ ਵੀ ਇੱਥੇ ਵੀ ਅਪੁਆਇੰਟਮੈਂਟਾਂ ਦੇ ਰਹੇ ਹਾਂ ਬੱਚਿਆਂ ਨੂੰ ਸੱਜੇ ਖੱਬੇ ਪੀ ਜੀ ਕਿਸੇ ਢੰਗ ਨਾਲ ਆ ਜਾਣ ਜਿੱਦਾਂ ਜਮੀਨਾਂ ਹੈ ਖੇਤੀਬਾੜੀ ਕਰਨੀ ਆ ਜੇ ਸਾਰੇ ਇੱਦਾਂ ਹੀ ਬੱਚੇ ਚੱਲ ਗਏ ਤਾਂ ਫਿਰ ਤਾਂ ਵੀ ਵਾਕਿਆ ਪੰਜਾਬ ਦੇ ਵਿੱਚ ਅਤੇ ਫਿਰ ਮੁਸ਼ਕਿਲ ਹੋ ਜੂਗੀ ਇਸ ਕਰਕੇ ਬਾਕੀ ਕੰਟਰੀਜ਼ ਮਤਲਬ ਸੱਜੇ ਖੱਬੇ ਜਾਂਦੇ ਨੇ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਬਸ ਬਸ ਬਸ ਤੁਸੀਂ ਨਾ ਟਰੈਂਡ ਹੋ ਗਿਆ ਜ਼ਿਆਦਾ ਟਰੈਂਡ ਦੇਖੋ ਦੇਖੀ ਜਿੱਦਾਂ ਇੱਕ ਦੋਸਤ ਜਾ ਰਿਹਾ ਬੱਚੇ ਦਾ ਦੂਜਾ ਵੀ ਫਿਰ ਇੱਕ ਪੇਰੈਂਟਸ ਜਾ ਰਿਹਾ ਉਹ ਫਿਰ ਗਿਟਮਿਟ ਜਦੋਂ ਕਰਦੇ ਆ ਸਲਾਹ ਗੱਲਾਂ ਬਾਤਾਂ ਕਰਦੇ ਹਾਂ ਨਾ ਜਦੋਂ ਅਤੇ ਉਹ ਫਿਰ ਤਿਆਰ ਹੋ ਜਾਂਦੇ ਵੀ ਹਾਂ ਬਈ ਜਾਣਾ ਚਾਹੀਦਾ ਹਾਂ ਹਾਂ ਹਾਂ ਚਲੋ ਖੈਰ ਕੋਈ ਗੱਲ ਨਹੀਂ ਹਾਂ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਜ਼ਮਾਨੇ ਦੇ ਨਾਲ ਚਲੋ ਠੀਕ ਹੈ ਓਕੇ ਓਕੇ ਓਕੇ ਠੀਕ ਠੀਕ ਠੀਕ